ਮੈਂ ਤੁਹਾਨੂੰ ਉਹ ਦੱਸਣਾ ਚਾਹੁੰਦਾ ਕੀ ਅੱਜ ਕੱਲ੍ਹ ਲੋਕਾਂ ਦਾ ਬਹੁਤ ਸਾਰਾ ਜਿਹੜਾ ਕਹਿੰਦੇ ਵੀ ਜਨੂੰਨ ਜਿਹੜਾ ਅੱਜ ਕੱਲ੍ਹ ਬਾਈਕਿੰਗ ਵੱਲ ਹੋਇਆ ਪਿਆ ਅਤੇ ਬਹੁਤ ਸਾਰੇ ਲੋਕ ਜਿਹੜੇ ਅੱਜ ਕੱਲ੍ਹ ਬਾਈਕਿੰਗ ਚਲਾਉਂਦੇ ਜਿਵੇਂ ਤੁਸੀਂ ਦੇਖ ਸਕਦੇ ਮਸ਼ਹੂਰੀਆਂ ਦੇ ਵਿੱਚ ਵੀ ਕਈ ਸਾਰੇ ਬਹੁਤ ਸਾਰੇ ਲੋਕ ਬਾਈਕ ਵੀ ਐਡ ਵੀ ਦੇਣ ਦੇ ਆ ਅੱਜ ਕੱਲ੍ਹ ਜਿਵੇਂ ਤੁਸੀਂ ਸਮਝਦੇ ਰੇਸਰ ਵੀ ਜਿਵੇਂ ਰੇਸਾਂ ਲਾਉਂਦੇ ਨੇ ਕਈ ਥਾਵਾਂ 'ਤੇ ਗੇਮਾਂ ਵੀ ਚਲਦੀਆਂ ਅਤੇ ਬਹੁਤ ਥਾਵਾਂ 'ਤੇ ਉਹ ਬਾਈਕ ਚਲਾਉਂਦੇ ਬਿਗ ਬੋਸ ਦੇ ਵਿੱਚ ਵੀ ਇਹ ਹੈਗੇ ਜਿਹੜੇ ਬਾਈਕ ਚਲਾਉਂਦੇ ਅਤੇ ਰੇਸ ਵੀ ਲਾਉਂਦੇ ਕਈ ਵਾਰ ਉਹਨਾਂ ਦਾ ਬਾਈਕਿੰਗ 'ਤੇ ਉੱਦਾਂ ਹੀ ਕਈ ਵਾਰ ਉਹਨਾਂ ਦਾ ਐਕਸੀਡੈਂਟ ਜਿਹਨੂੰ ਕਹਿੰਦੇ ਥੋੜ੍ਹਾ ਜਾ ਨੁਕਸਾਨ ਵੀ ਹੋ ਜਾਂਦਾ ਵਾ ਅਤੇ ਕਈ ਲੋਕ ਜਦੋਂ ਬਾਈਕ ਚਲਾਉਂਦੇ ਅਤੇ ਆਪਣੇ ਆਪ ਨੂੰ ਬਹੁਤ ਹੀ ਮਹਿਸੂਸ ਕਰਦੇ ਹਨ ਜਿਵੇਂ ਬਾਈਕ 'ਤੇ ਕਿਤੇ ਵੀ ਆਉਣਾ ਆਉਣਾ ਹੋਵੇ ਅਤੇ ਇੱਕ ਹੈਗਾ ਵਾ ਮੈਨ ਹੈਗਾ ਜਿਹੜਾ ਨਾ ਹੈਗਾ ਮਾਂ ਕਬੀ ਮੋਟ ਨਾਂ ਦਾ ਮੈਨ ਹੈਗਾ ਜਿਹਨੇ ਕਹਿੰਦੇ ਪੂਰੇ ਵਰਲਡ ਦੇ ਬਾਈਕ 'ਤੇ ਬਾਈਕ 'ਤੇ ਜਾ ਕੇ ਇੱਦਾਂ ਹੀ ਰਾਊਂਡ ਲਾਏ ਨੇ ਬਹੁਤ ਦੂਰ ਦੂਰ ਤੱਕ ਉਹ ਜਾਂਦਾ ਰਹਿੰਦਾ ਇੱਦਾਂ ਹੀ ਉਹਦਾ ਸ਼ੌਂਕ ਹੈਗਾ ਅਤੇ ਉੱਦਾਂ ਵੀ ਕਈ ਗੱਲ ਬਹੁਤ ਸਾਰਿਆਂ ਦਾ ਇੱਕ ਹਿਸਾਬ ਦਾ ਕਹਿੰਦੇ ਆਪਾਂ ਟਰੈਂਡ ਹੀ ਹੋ ਗਿਆ ਵੀ ਬਾਈਕ ਲੈਣੀ ਨਵੀਂ ਬਾਈਕ ਕਢਾ ਲਈ ਅਤੇ ਉਹ ਸੋ ਪੇਪਰ ਵੇਂਹਦੇ ਨੇ ਵੀ ਇਹ ਕੰਪਨੀ ਚਲੋ ਜਿੱਦਾਂ ਦੀ ਵੀ ਉਹ ਲੇ ਲੈਂਦੇ ਮਹਿੰਗੀ ਮਹਿੰਗੀ ਬਾਈਕ ਲੇ ਲੈਂਦੇ ਜਿੱਦਾਂ ਤੁਹਾਨੂੰ ਪਤਾ ਆਰ ਪੰਦਰਾਂ ਹੋ ਗਿਆ ਅਪਾਚੀ ਹੋ ਗਿਆ ਅਤੇ ਸਟੰਟ ਬਣਾਉਂਦੇ ਅਤੇ ਉੱਥੇ ਬਾ ਤੁਹਾਨੂੰ ਪਤਾ ਰੀਲਾਂ ਵੀ ਬਹੁਤ ਸਾਰੀਆਂ ਬਣਾਉਂਦੇ ਨੇ ਫਿਰ ਕੁਛ ਉਹਦੇ ਕੋਡਿੰਗ ਉਹ ਪੈ ਪੈਸੇ ਵੀ ਜਿਹੜੇ ਹੁੰਦੇ ਵੀ ਪੈਸੇ ਆਪਣੀ ਮਨੀ ਕਹਿੰਦੇ ਆ ਉਹ ਵੀ ਥੋੜੀ ਜਿਹੀ ਆਪਣੀ ਕਮਾ ਲੈਂਦੇ ਮਨੀ ਵੀ ਕਮਾ ਲੈਂਦੇ ਥੈਂਕ ਯੂ